ਮੇਰੇ ਰਸੋਈ ਘਰ ਦੇ ਵਿੱਚ ਗੈਸ ਅਤੇ ਸਿਲੰਡਰ ਲਾਈਟਰ ਅੱਗ ਬਾਲਣ ਦੇ ਲਈ ਅਤੇ ਹਵਾ ਦੇ ਅਤੇ ਹਵਾ ਨਿਕਲੇ ਉਹਦੇ ਲਈ ਚਿਮਨੀ ਇਹ ਸਾਰਾ ਕੁਛ ਲੱਗਿਆ ਹੋਇਆ ਹੈ ਅਤੇ ਇੱਕ ਪੱਖਾ ਵੀ ਲੱਗਿਆ ਹੋਇਆ ਜਿਸ ਤੋਂ ਜਿਹੜਾ ਧੂੰਆਂ ਹੈ ਉਹ ਬਾਹਰ ਨਿਕਲਦਾ ਹੈ ਅਤੇ ਫਰਿਜ਼ ਬਚਿਆ ਹੋਇਆ ਸਮਾਨ ਰੱਖਣ ਦੇ ਲਈ ਹੈ ਬਰਤਨ ਮਾਂਜਣ ਦੇ ਲਈ ਟੂਟੀ ਲੱਗੀ ਹੋਈ ਹੈ ਅਤੇ ਹੋਰ ਵੀ ਬਹੁਤ ਕੁਝ ਸਾਡੀ ਰਸੋਈ ਦੇ ਵਿੱਚ ਹੈ ਜੋ ਕਿ ਸਾਡੇ ਸਾਨੂੰ ਖਾਣਾ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦਗਾਰ ਮਦਦ ਕਰਦੀ ਹੈ ਪਰ ਪਹਿਲੇ ਕਿ ਪਹਿਲੇ ਦੇ ਸਮੇਂ ਦੇ ਵਿੱਚ ਅੱਜ ਵੀ ਜੇਕਰ ਅਸੀਂ ਪਿੰਡ ਚਲੇ ਜਾਣ ਤਾਂ ਉਹ ਸਾਨੂੰ ਪਹਿਲੇ ਪਹਿਲੇ ਪਹਿਲਾਂ ਵਾਲਾ ਸਮਾਂ ਕਿਤੇ ਨਾ ਕਿਤੇ ਦਿੱਖ ਜਾਏਗਾ ਚੁੱਲ੍ਹਿਆਂ 'ਤੇ ਰੋਟੀ ਬਣਦੀ ਹੈ ਚੁਹਲਿਆਂ 'ਤੇ ਸਬਜ਼ੀ ਬਣਦੀ ਹੈ ਚੁੱਲ੍ਹਿਆਂ 'ਤੇ ਅੱਗ ਬਾਲਣ ਦੇ ਲਈ ਲੱਕੜੀਆਂ ਕੱਟਣਾ ਪੈਂਦਾ ਹੈ ਅਤੇ ਧੂੰਆਂ ਹੁੰਦਾ ਹੈ ਅਤੇ ਬਹੁਤ ਕੁਛ ਬਟ ਤਾਂ ਵੀ ਉਹ ਸਮਾਂ ਅਤੇ ਅੱਜ ਦਾ ਸਮਾਂ ਸਮੇਂ ਦੇ ਵਿੱਚ ਕਾਫੀ ਜ਼ਮੀਨ ਆਸਮਾਨ ਦਾ ਫਰਕ ਹੈ ਉਹਦੇ ਵਿੱਚ ਉਹ ਸਮੇਂ ਦੇ ਵਿੱਚ ਖਾਣ ਖਾਣ ਪੀਣ ਦੇ ਵਿੱਚ ਇੱਕ ਪੌਸ਼ਟਿਕ ਆਹਾਰ ਮਿਲਦਾ ਸੀ ਅੱਜ ਦੇ ਗੈਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਗੈਸਾਂ ਮੌਜੂਦ ਹੁੰਦੀਆਂ ਜੋ ਕਿ ਸਾਡੇ ਖਾਣੇ ਨੂੰ ਖਾਣ ਪੀਣ ਦੇ ਸਮਾਨ ਨੂੰ ਕਿਤੇ ਨਾ ਕਿਤੇ ਖਰਾਬ ਕਰਦੀਆਂ ਹਨ ਔਰ ਜੋ ਕਿ ਸਾਡੇ ਸਰੀਰ ਦੇ ਲਈ ਹਾਨੀਕਾਰਕ ਹੁੰਦੀਆਂ ਹਨ ਪਰ ਉਹ ਸਮੇਂ ਇਹੋ ਜਿਹਾ ਕੁਛ ਨਹੀਂ ਸੀ ਥੋੜ੍ਹਾ ਜਿਹਾ ਮੁਸ਼ਕਿਲ ਹਾਲਾਤ ਸੀ ਉਸ ਸਮੇਂ ਪਰ ਉਹ ਸਮੇਂ ਦੀ ਗੱਲ ਹੀ ਵੱਖਰੀ ਹੈ ਮੈਨੂੰ ਇੱਦਾਂ ਦਾ ਲੱਗਦਾ ਹੈ ਕਿ ਅੱਜ ਦੇ ਸਮੇਂ ਅਤੇ ਉਹ ਸਮੇਂ ਅਸੀਂ ਅਗਰ ਉਹਨਾਂ ਨੂੰ ਇੱਕ ਇੱਕੋ ਤਰ੍ਹਾਂ ਬੈਲੈਂਸ ਕਰਕੇ ਚੱਲੀਏ ਤਾਂ ਸਾਨੂੰ ਇੱਕ ਕਾਫੀ ਚੰਗਾ ਮਾਹੌਲ ਮਿਲੇਗਾ ਅਤੇ ਸਾਨੂੰ ਪੋਸ਼ਟਿਕ ਆਹਾਰ ਵੀ ਮਿਲੇਗਾ ਸਾਨੂੰ ਮਾਂ ਦਾ ਪਿਆਰ ਵੀ ਮਿਲੇਗਾ